ਨਮਸਕਾਰ ਮੇਰਾ ਨਾਮ ਸ਼ਾਕਸ਼ੀ ਹੈ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੇਰੇ ਮਾਤਾ ਪਿਤਾ ਦੀ ਸਿੱਖਿਆ ਬਾਰ੍ਹਵੀਂ ਪਾਸ ਹੈ ਓਹ ਦੋਵੇਂ ਹੀ ਬਾਰ੍ਹਵੀਂ ਪਾਸ ਹਨ ਅਤੇ ਮੇਰੇ ਦਾਦੀ ਦਾਦਾ ਦੀ ਸਿੱਖਿਆ ਮਿਡਲ ਪਾਸ ਹੈ ਕਿਉਂਕਿ ਮੇਰੇ ਦਾਦੀ ਦਾਦੇ ਦੇ ਸਮੇਂ 'ਤੇ ਸ ਸਿੱਖਿਆ ਦੇ ਚੰਗੇ ਮੌਕੇ ਬਿਲਕੁਲ ਵੀ ਨਹੀਂ ਸਨ ਉਸ ਸਮੇਂ ਲੋਕ ਸਿਰਫ਼ ਅੱਠ ਮਿਡਲ ਜਾਂ ਫਿਰ ਮੈਟ੍ਰਿਕ ਕਕਸ਼ਾ ਹੀ ਪਾਸ ਕਰਦੇ ਸੀ ਹੁਣ ਤਾਂ ਇਹ ਸਤਰ ਕਾਫ਼ੀ ਉੱਚਾ ਹੋ ਗਿਆ ਹੈ ਹੁਣ ਵਿੱਦਿਆ ਦਾ ਸਤਰ ਕਾਫ਼ੀ ਉੱਤੇ ਪੁੱਜ ਗਿਆ ਹੈ ਜਿਸ ਤਰ੍ਹਾਂ ਲੋਕ ਕਾਫ਼ੀ ਜ਼ਿਆਦਾ ਸਿੱਖਿਆ ਗ੍ਰਹਿਣ ਕਰਦੇ ਹਨ ਪਰ ਪਹਿਲਾਂ ਅਜਿਹੇ ਬਿਲਕੁਲ ਵੀ ਮੌਕੇ ਨਹੀਂ ਸੀ ਪਹਿਲਾਂ ਲੋਕ ਸਿਰਫ ਮੈਟ੍ਰਿਕ ਜਾਂ ਫਿਰ ਮਿਡਲ ਹੀ ਪਾਸ ਕਰਦੇ ਸੀ ਉਹਨਾਂ ਨੂੰ ਸਿੱਖਿਆ ਦੇ ਮੌਕੇ ਤਾਂ ਨਹੀਂ ਮਿਲੇ ਪਰ ਹੁਣ ਇਸ ਦਾ ਸਤਰ ਉੱਚਾ ਹੋਣ ਕਰਕੇ ਲੋਕ ਕਾਫ਼ੀ ਦੂਰ ਦੂਰ ਤੱਕ ਪਹੁੰਚ ਰਹੇ ਹਨ ਪਹਿਲਾਂ ਦੇ ਸਮਿਆਂ ਦੇ ਲੋਕਾਂ ਨੂੰ ਕਾਫ਼ੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਹਨਾਂ ਦੀ ਪੜ੍ਹਾਈ ਵੀ ਥੋੜ੍ਹੀ ਹੀ ਸੀ ਪਰ ਹੁਣ ਤਾਂ ਲੋਕ ਕਾਫ਼ੀ ਕਾਫ਼ੀ ਦੂਰ ਤੱਕ ਪੜ੍ਹਦੇ ਹਨ ਅਤੇ ਉਹਨਾਂ ਨੂੰ ਪੜ੍ਹਨਾ ਵੀ ਚਾਹੀਦਾ ਹੈ ਸਾਨੂੰ ਸਿੱਖਿਆ ਦੇ ਮੌਕੇ ਸੁਧਾਰਨੇ ਚਾਹੀਦੇ ਹਨ ਜਿਵੇਂ ਕਿ ਸਰਕਾਰ ਨੇ ਇੱਕ ਮੌਕਾ ਤਾਂ ਸੁਧਾਰਿਆ ਹੀ ਹੋਇਆ ਹੈ ਜਿ ਜਿਵੇਂ ਪਹਿਲੇ ਲੋਕ ਅੱਠਵੀਂ ਤੱਕ ਪੜ੍ਹਦੇ ਸੀ ਅੱਜ ਕੱਲ੍ਹ ਤਾਂ ਹਰ ਇੱਕ ਲਈ ਅੱਠਵੀਂ ਤੱਕ ਸਿੱਖਿਆ ਫ਼ਰੀ ਹੈ ਅਤੇ ਲਾਜ਼ਮੀ ਕੀਤੀ ਗਈ ਹੈ ਲੋਕ ਦੱਸਵੀਂ ਤੱਕ ਤਾਂ ਫ਼ਰੀ ਪੜ੍ਹਦੇ ਹਨ ਅਤੇ ਓਹ ਸਿੱਖਿਆ ਹਰ ਇੱਕ ਲਈ ਜ਼ਰੂਰੀ ਹੈ ਇਸੇ ਤਰ੍ਹਾਂ ਸਰਕਾਰ ਨੂੰ ਹੋਰ ਵੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਨ੍ਹਾਂ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਸ਼ਿਕਸ਼ਿਤ ਬਣ ਸਕਣ ਅਤੇ ਦੇਸ਼ ਤਰੱਕੀਆਂ 'ਤੇ ਪਹੁੰਚ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ